ਸਰ ਸਰ ਮੈਨੂੰ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਹੈ ਤੇ ਵੀਜ਼ਾ ਅਪਲਾਈ ਕਰਨ ਵਾਲੇ ਇਨਕਮ ਟੈਕਸ ਦੀ ਡਿਟੇਲ ਮੰਗ ਰਹੇ ਹ ਤੇ ਮੈਂ ਦੋ ਸਾਲ ਮੈਂ ਦੋ ਸਾਲਾ ਤੋਂ ਰਿਟਰਨ ਇਨਕਮ ਟੈਕਸ ਦੀ ਰਿਟਰਨ ਭਰ ਰਹੀ ਆਂ ਤੇ ਮੇਰਾ ਮੇਰਾ ਦੋ ਸਾਲਾਂ ਦਾ ਰਿਟਰਨ ਦਾ ਫੋਰਮੈਟ ਮੈਨੂੰ ਦਿੱਤਾ ਜਾਵੇ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਕਿਸ ਵੈਬਸਾਈਟ ਤੋਂ ਡਾਊਨਲੋਡ ਕਰਾ ਜਾਂ ਫਿਰ ਕਿਸ ਆਫਿਸ ਵਿੱਚ ਜਾ ਕੇ ਆਪਣੇ ਡਾਕੂਮੈਂਟਸ ਲੈ ਸਕਾਂ